ਫੋਟੋਗ੍ਰਾਫੀ ਵਰਕਸ਼ਾਪਾਂ ਦੇ ਵਿੱਚ ਹਿੱਸਾ ਤਾਂ ਨਹੀਂ ਮੈਂ ਲਿਆ ਪਰ ਜਿਹੜੀਆਂ ਫੋਟੋਗ੍ਰਾਫੀ ਦੀਆਂ ਤ ਤਕਨੀਕ ਤਕਨੀਕਾਂ ਸਿੱਖੀਆਂ ਨੇ ਉਹ ਮੈਂ ਜਿੱਦਾਂ ਮੇਰਾ ਸ਼ੌਂਕ ਹੈ ਫੋਟੋਗ੍ਰਾਫੀ ਕਰਨਾ ਮੈਂ ਜੰਗਲਾਂ ਦੇ ਵਿੱਚ ਵੀ ਜਿੱਦਾਂ ਪ ਮੰਨ ਲਓ ਚਿੜੀਆ ਘਰਾਂ ਦੇ ਵਿੱਚ ਜੰਗਲਾਂ ਦੇ ਵਿੱਚ ਕੁਦਰਤੀ ਜਿਹੜੇ ਨਜ਼ਾਰੇ ਨੇ ਉਹਨਾਂ ਨੂੰ ਮੈਂ ਕੈਪਚਰ ਕਰਦਾਂ ਅਤੇ ਉਹ ਮੈਂ ਆਪਣੀ ਇੱਕ ਐਲਬਮ ਵੀ ਬਣਾ ਰੱ ਬਣਾ ਰੱਖੀ ਹੈ ਅਤੇ ਉਹਦੇ ਵਿੱਚ ਮੈਂ ਸਾ ਸਾਂਭ ਸੰਭਾਲ ਕਰਦਾਂ ਉਹਨਾਂ ਦੀ ਇਹ ਮੇਰਾ ਜਿਹੜਾ ਸ਼ੌਂਕ ਹੈ ਹੌਲੀ ਹੌਲੀ ਤਕਨੀਕਾਂ ਸਿੱਖਦਾ ਸਿੱਖਦਾ ਅਤੇ ਇਹਦੇ ਵਿੱਚ ਇਹ ਹੈ ਵੀ ਜਿਹੜਾ ਕੈਮਰਾ ਬਹੁਤ ਵੱਡਾ ਚੀਜ਼ ਹੈ ਜਿਹਦਾ ਯੋਗਦਾਨ ਹੈ ਜਿਹਦੇ ਹਿਸਾਬ ਦੇ ਨਾਲ ਫੋਟੋਆਂ ਵਧੀਆ ਖਿੱਚੀਆਂ ਜਾਂਦੀਆਂ ਨੇ